ਭਾਰਤ ਦੀਆਂ ਜਿਹੜੀਆਂ ਫਿਲਮਾਂ ਨੇ ਜਿਵੇਂ ਕਿ ਹਿੰਦੀ ਫੀਚਰ ਫਿਲਮਾਂ ਨੇ ਵੀ ਇਹਨਾਂ ਵੀ ਅਸੀਂ ਜਦੋਂ ਇਹਨਾਂ ਨੂੰ ਦੇਖਦੇ ਹਾਂ ਤਿੰਨ ਘੰਟੇ ਇਹ ਸਾਨੂੰ ਐ ਲੱਗਦਾ ਜਿਵੇਂ ਇਹ ਸੁਪਨਾ ਹੀ ਹੁੰਦੀਆਂ ਨੇ ਕਿਉਂਕਿ ਜਿਹੜੇ ਐਕਟਰ ਐਕਟਰਾਂ ਦੇ ਜਿਹੜੇ ਮਾਂ ਬਾਪ ਹੁੰਦੇ ਨੇ ਉਹ ਵੀ ਫਿਲਮਾਂ ਦੇ ਵਿੱਚ ਐਕਟਰਿੰਗ ਕਰਦੇ ਹੁੰਦੇ ਨੇ ਅਤੇ ਨਾਲੇ ਉਹਨਾਂ ਦੇ ਬੱਚੇ ਵੀ ਐਕਟ ਐਕਟਰ ਬਣ ਜਾਂਦੇ ਨੇ ਅਤੇ ਅਸੀਂ ਜਿਵੇਂ ਫਿਲਮ ਤਿੰਨ ਘੰਟੇ ਦੇਖਦੇ ਹਾਂ ਤਾਂ ਸਾਨੂੰ ਐ ਲੱਗਦਾ ਜਿਵੇਂ ਵੀ ਸੁ ਇੱਕ ਸੁਪਨਾ ਹੀ ਹੁੰਦਾ ਇਹ ਜਿਵੇਂ ਕੋਈ ਜਿਵੇਂ ਅਮਿਤਾਬ ਬਚਨ ਹੈ ਇਹ ਐਕਟਿੰਗ ਫਿਲਮਾਂ ਦੇ ਵਿੱਚ ਬਹੁਤ ਵਧੀਆ ਕਰਦੇ ਨੇ ਇਹ ਇੱਕ ਤਾਂ ਕੱਦ ਤੋਂ ਲੰਬੇ ਹੁੰਦੇ ਨੇ ਅਤੇ ਇਹਨਾਂ ਦਾ ਬੋਲ ਵੀ ਬਹੁਤ ਭਾਰੀ ਹੁੰਦਾ ਅਤੇ ਇਹ ਸ਼ੋਲੇ ਫਿਲਮ ਦੇ ਵਿੱਚ ਜਿਹੜਾ ਤੁਹਾਨੂੰ ਗਾਣਾ ਪਸੰਦ ਆ ਉਹ ਹੈਗਾ ਹੈ ਅਸੀਂ ਦੋਸਤੀ ਨਹੀਂ ਤੋੜਾਂਗੇ ਇਹ ਫਿਲਮ ਬਹੁਤ ਵਧੀਆ ਅਤੇ ਇਹ ਗਾਣਾ ਵੀ ਬਹੁਤ ਵਧੀਆ ਲੱਗਦਾ ਹੈ